ਦੁਨੀਆ ਵਿੱਚ ਭਾਰਤੀ ਕਲਾ ਅਤੇ ਕਲ ਕਲਾਕਾਰ ਦੀ ਪ੍ਰਤਿਨਿਧਤਾ ਵਧਾਉਣ ਲਈ ਸਾਨੂੰ ਭਾਰਤੀ ਕਲਾਕਾਰਾਂ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਤਾਂ ਜੋ ਹੋਰ ਵੀ ਵਧੀਆ ਕੰਮ ਕਰ ਸਕਣ ਜਿਵੇਂ ਕਿ ਦੁਨੀਆ ਦੇ ਵਿੱਚ ਵੀ ਸਾਡਾ ਜਿਹੜਾ ਕਲਚਰ ਜਾਣਿਆ ਜਾਵੇ ਸਾਡਾ ਭਾਰਤੀ ਕਲਾ ਨੂੰ ਮਾਨਤਾ ਮਿਲ ਸਕੇ ਜਿਵੇਂ ਹੁਣ ਕਈ ਆਪਣੇ ਕਸ਼ਮੀਰ ਵੱਲ ਆਪਾਂ ਜਾਈਏ ਤਾਂ ਉੱਥੇ ਕਸ਼ਮੀਰੀ ਸ਼ੋਲ ਜਿਹੜੇ ਬਹੁਤ ਹੀ ਜ਼ਿਆਦਾ ਪ੍ਰਸਿੱਧ ਨੇ ਜਿਹੜੇ ਇੰਡੀਆ ਦੇ ਵਿੱਚ ਵੀ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਅਤੇ ਫੋਰਨ ਦੇ ਲੋਕ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਅਤੇ ਇਸ ਤਰੀਕੇ ਨਾਲ ਅਸੀਂ ਉਹਨਾਂ ਦਾ ਕਾਰੋਬਾਰ ਵੀ ਉਹ ਵਧਾ ਸਕਦੇ ਨੇ ਜੋ ਵੀ ਕਲਾਕਾਰ ਨੇ ਉਹ ਉਸ ਤਰੀਕੇ ਨਾਲ ਜਿਵੇਂ ਯੂਟਿਊਬ ਲੋਕ ਯੂਜ ਕਰਦੇ ਨੇ ਇੰਟਰਨੈੱਟ ਯੂਜ ਕਰਦੇ ਨੇ ਤਾਂ ਆਪਾਂ ਜਿਵੇਂ ਕਿਸੇ ਦੇ ਵਿੱਚ ਕੋਈ ਟੈਲੈਂਟ ਹੋਵੇ ਜਿਵੇਂ ਸਿੰਗਰ ਨੇ ਸਿੰਗਰ ਆਪਣਾ ਵਧੀਆ ਸਿੰਗਿੰਗ ਕਰਕੇ ਉਸ ਚੀਜ਼ ਨੂੰ ਯੂਟਿਊਬ 'ਤੇ ਸ਼ੇਅਰ ਕਰਦੇ ਨੇ ਅਤੇ ਲੋਕ ਉਹਨੂੰ ਦੇਖਦੇ ਨੇ ਅਤੇ ਮੋਟੀਵੇਟ ਹੁੰਦੇ ਨੇ ਹੈ ਨਾ ਉਸ ਤਰੀਕੇ ਨਾਲ ਕੁਛ ਹੋਰ ਚੀਜ਼ਾਂ ਜਿਵੇਂ ਮਿੱਟੀ ਦੇ ਭਾਂਡੇ ਕੁਛ ਸਾਡੇ ਇਹ ਬਹੁਤ ਹੀ ਜ਼ਿਆਦਾ ਖਾਸ ਮੰਨਿਆ ਜਾਂਦਾ ਆ ਕਿ ਇੰਡੀਆ ਦੇ ਵਿੱਚ ਲੋਕ ਮਿੱਟੀ ਦੇ ਭਾਂਡਿਆਂ ਦੇ ਵਿੱਚ ਖਾਣਾ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤਾਂ ਅਸੀਂ ਉਸ ਚੀਜ਼ ਨੂੰ ਵੀ ਅਸੀਂ ਪ੍ਰਮੋਟ ਕਰ ਸਕਦੇ ਹਾਂ ਡਿਜੀਟਲੀ ਤਾਂ ਜੋ ਲੋਕਾਂ ਨੂੰ ਵੀ ਸਾਡੇ ਕਲਚਰ ਬਾਰੇ ਪਤਾ ਲੱਗ ਸਕੇ ਅਤੇ ਭਾਰਤੀ ਕਲਾ ਨੂੰ ਇੱਕ ਹੋਰ ਉਚਾਈਆਂ 'ਤੇ ਅਸੀਂ ਲਿਜਾ ਸਕੀਏ